ਜਿਸ ਕੱਪੜੇ ਨੂੰ ਮੈਂ ਡਿਜਾਈਨ ਕਰਨਾ ਹੈ ਉਸਦਾ ਪੈਟਰਨ ਮੈਂ ਔਨਲਾਈਨ ਖਰੀਦਿਆ ਹੈ ਔਨਲਾਈਨ ਮੈਨੂੰ ਬਹੁਤ ਵਧੀਆ ਪੈਟਰਨ ਮਿਲਿਆ ਹੈ ਮੇਰੇ ਵਿਚਾਰ ਨਾਲ ਔਨਲਾਈਨ ਪੈਟਰਨ ਬਹੁਤ ਵਧੀਆ ਰਹਿੰਦਾ ਹੈ ਅਤੇ ਇਸ ਮਤਲਬ ਵੀ ਮੈਂ ਇਸ ਪੈਟਰਨ ਨੂੰ ਖਰੀਦ ਕੇ ਬਹੁਤ ਜ਼ਿਆਦਾ ਮਤਲਬ ਖੁਸ਼ ਹਾਂ ਮੈਨੂੰ ਬਹੁਤ ਵਧੀਆ ਪੈਟਰਨ ਲੱਗਿਆ ਕੋਈ ਵੀ ਇੱਦਾਂ ਦੀ ਇਸ ਵਿੱਚ ਕੋਈ ਵੀ ਦਿੱਕਤ ਨਹੀਂ ਕ ਪੈਟਰਨ ਬਹੁਤ ਵਧੀਆ ਮੈਂ ਇਸ ਪੈਟਰਨ ਨੂੰ ਖਰੀਦ ਕੇ ਆਪਣੇ ਲਈ ਬਹੁਤ ਵਧੀਆ ਡਿਜ਼ਾਇਨ ਬਣਾਉਣਾ ਮੈਂ ਮੇਰਾ ਮਨ ਪਸੰਦ ਬ੍ਰੈਂਡ ਮਤਲਬ ਅਲਾਡੋ ਅਰਾਡੋ ਹੈ ਮਤਲਬ ਓਸ ਉਸ ਬ੍ਰੈਂਡ ਵਿੱਚ ਬਹੁਤ ਵਧੀਆ ਕੁਲੈਕਸ਼ਨ ਹੈ ਬਹੁਤ ਜ਼ਿਆਦਾ ਵਧੀਆ ਕੁਲੈਕਸ਼ਨ ਦੀ ਹਰ ਇੱਕ ਚੀਜ਼ ਮਿਲਦੀ ਹੈ ਮੈਂ ਖੁਦ ਆਪਣੇ ਲਈ ਉਸ ਮਤਲਬ ਬ੍ਰੈਂਡ ਤੋਂ ਕੁਲੈਕਸ਼ਨ ਲੈਤੀ ਹੈ ਮਤਲਬ ਬਹੁਤ ਜ਼ਿਆਦਾ ਵਧੀਆ